ਜਦ ਵੀ ਅਸੀਂ ਸਕੂਲ ਬਾਰੇ ਗੱਲ ਕਰਦੇ ਹਾਂ ਤਾਂ ਸਾਨੂੰ ਸਾਰਿਆਂ ਨੂੰ ਆਪਣੇ ਪੁਰਾਣੇ ਯਾਰਾਂ ਅਤੇ ਟੀਚਰਾਂ ਬਾਰੇ ਯਾਦ ਆਉਂਦੀ ਹੈ ਪਰ ਜੇ ਮੈਂ ਗੱਲ ਕਰਾਂ ਤਾਂ ਮੇਰਾ ਸਕੂਲ ਵਿੱਚ ਸਭ ਤੋਂ ਫੇਵਰੇਟ ਸਬਜੈਕਟ ਸੀ ਸਰੀਰਕ ਸਿਕ ਸ਼ਿਕਸ਼ਾ ਜਿਹਦੇ ਬਾਰੇ ਅਸੀਂ ਗੱਲ ਕਰੀਏ ਤਾਂ ਇਹ ਸਭ ਤੋਂ ਹੀ ਵੱਧ ਵਧੀਆ ਸਬਜੈਕਟ ਮੰਨਿਆ ਜਾਂਦਾ ਹੈ ਜੇ ਇਹਦੇ ਬਾਰੇ ਮੈਂ ਗੱਲ ਕਰਾਂ ਕਿ ਮੈਂ ਇਸਨੂੰ ਕਿਉਂ ਆਨੰਦ ਨੰਦ ਆਨੰਦਮਈ ਤਰੀਕੇ ਨਾਲ਼ ਲੈਂਦਾ ਸੀ ਤਾਂ ਇੱਕ ਇਹ ਗੱਲ ਕੀਤੀ ਜਾਵੇ ਤਾਂ ਇਸ ਨੇ ਮੈਨੂੰ ਮੇਰੇ ਯਾਰਾਂ ਮੇਰੇ ਸਰੀਰ ਅਤੇ ਮੇਰੀ ਖੂਬੀ ਨੂੰ ਉਤਸ਼ਾਹਿਤ ਕੀਤਾ ਹੈ ਅਤੇ ਇਹਨੂੰ ਬਾਹਰ ਕੱਢਿਆ ਹੈ ਇਹ ਸਿਖ ਇਹ ਸਿੱਖਿਆ ਕਰਕੇ ਮੈਂ ਸਾਰਾ ਦਿਨ ਗਰਾਊਂਡ 'ਚ ਧੁੱਪੇ ਖੇਡਦਾ ਸੀ ਆਪਣੇ ਆਪ ਨੂੰ ਫਿੱਟ ਰੱਖਦਾ ਸੀ ਅਤੇ ਇਸਨੇ ਮੈਨੂੰ ਮੇਰੀ ਜ਼ਿੰਦਗੀ ਦਾ ਨਵਾਂ ਫੋਕਸ ਅਤੇ ਮੇਰੀ ਜ਼ਿੰਦਗੀ ਦਾ ਰਾਹ ਦਿਖਾਇਆ ਹੈ ਇਹਦੇ ਨਾਲ਼ ਮੈਂ ਇਸ ਇਹਦੇ ਨਾਲ਼ ਮੈਂ ਆਪਣੇ ਸਰੀਰ ਆਪਣੇ ਕਰੀਅਰ ਅਤੇ ਆਪਣੀ ਜ਼ਿੰਦਗੀ ਉੱਤੇ ਬਹੁਤ ਹੀ ਤਰੀਕੇ ਨਾਲ਼ ਧਿਆਨ ਦਿੰਦਾ ਹਾਂ ਜਿਹਦੇ ਨਾਲ਼ ਨਾਲ਼ ਮੈਂ ਪੂਰੇ ਤਰੀਕੇ ਨਾਲ਼ ਆਪਣਾ ਕੰਮ ਕਰਦਾ ਪਿਆ ਹਾਂ ਇਹ ਸਿੱਖਿਆ ਮੇਰੇ ਲਈ ਬਹੁਤ ਹੀ ਉਤਸ਼ਾਹਿਤ ਹੈ ਅਤੇ ਮੈਨੂੰ ਬਹੁਤ ਹੀ ਵੱਡੇ ਪੱਧਰ ਤੱਕ ਲੈ ਕੇ ਗਈ ਆ ਜੇ ਮੈਂ ਗੱਲ ਕਰਾਂ ਤਾਂ ਇਹ ਸਬਜੈਕਟ ਮੈਂ ਕਿਉਂ ਲਿਆ ਸੀ ਤਾਂ ਇਹ ਮੇਰੀ ਰੁਚੀ ਸੀ ਅਤੇ ਮੈਨੂੰ ਸਪੋਰਟਸ ਤੋਂ ਇਲਾਵਾ ਹੋਰ ਕੋਈ ਚੀਜ਼ ਪਸੰਦ ਨਹੀਂ ਸੀ ਮੈਂ ਸ਼ੁਰੂ ਤੋਂ ਸਿਰਫ਼ ਸਪੋਰਟਸ ਵੱਲ ਹੀ ਧਿਆਨ ਦਿੰਦਾ ਸੀ ਜਿਹਦੇ ਕਰਕੇ ਮੈਨੂੰ ਇਹ ਸਬਜੈਕਟ ਚੂਜ ਕਰਨਾ ਪਿਆ ਇਸਨੇ ਮੈਨੂੰ ਮੇਰੇ ਯਾਰਾਂ ਨਾਲ਼ ਜੋੜਿਆ ਅਤੇ ਮੇਰੀ ਅਗਲੀ ਅਗਲੀ ਜ਼ਿੰਦਗੀ ਵਿੱਚ ਮੇਰੇ ਯਾਰਾਂ ਦਾ ਮਹੱਤਵ ਵੀ ਦੱਸਿਆ ਹੈ ਇਹ ਨੇ ਮੈਨੂੰ ਸ਼ੁਰੂ ਤੋਂ ਲੈ ਕੇ ਹੁਣ ਤੱਕ ਫਿੱਟ ਰੱਖਿਆ ਹੈ ਜਿਹਦੇ ਕਰਕੇ ਮੈਂ ਤੰਦਰੁਸਤ ਹਾਂ ਅਤੇ ਬਿਮਾਰੀ ਤੋਂ ਦੂਰ ਰਹਿੰਦਾ ਹਾਂ ਮੈਂ ਬਹੁਤ ਹੀ ਖੁਸ਼ ਹਾਂ ਕਿ ਮੈਂ ਇਹ ਸ ਸਬਜੈਕਟ ਸਕੂਲ 'ਚ ਚੂਜ ਕੀਤਾ ਸੀ ਅਤੇ ਅਤੇ ਮੈਂ ਆਪਣੇ ਆਪਣੀ ਲਾਈਫ ਵਿੱਚ ਇਸ ਨੂੰ ਬਹੁਤ ਹੀ ਵਧੀਆ ਤਰੀਕੇ ਨਾਲ਼ ਸਥਾਪਿਤ ਕਰ ਰਿਹਾ ਹਾਂ